ਹੈਲੋ ਹਾਂਜੀ ਮੈਂ ਜ਼ਿਆਦਾ ਲੇਟ ਪਹੁੰਚੀ ਸੀ ਸੋਰੀ ਮੈਡਮ ਪਰ ਨਾ ਮੈਮ ਕਰਾਂ ਕਿ ਟਰੈਫਿਕ ਹੀ ਬਹੁਤ ਆਪਣੇ ਸ਼ਹਿਰ 'ਚ ਸਾਰੇ ਰੋਡਸ ਜਿਹੜੇ ਰੋਡ 'ਤੇ ਵੀ ਜਾਓ ਟਰੈਫਿਕ ਹੀ ਟਰੈਫਿਕ ਤੁਸੀਂ ਵੀ ਤੁਹਾਨੂੰ ਵੀ ਦਿੱਕਤ ਆ ਰਹੀ ਹੋਣੀ ਤੁਹਾਡੇ ਏਰੀਆ ਵਾਲੀ ਸਾਈਡ ਤੋਂ ਵੀ ਟਰੈਫਿਕ ਕਾਫੀ ਹੁੰਦਾ ਹਾਂਜੀ ਹਾਂਜੀ ਉਤੋਂ ਦੀ ਲਾਈਟਾਂ ਵੀ ਖ਼ਰਾਬ ਹੋ ਰੱਖੀਆਂ ਮੇਨ ਰੋਡ ਵਾਲੀਆਂ ਲਾਈਟਸ ਵੀ ਨਹੀਂ ਚਲਦੀਆਂ ਜਿਹਦੇ ਕਰਕੇ ਟਰੈਫਿਕ ਜਾਮ ਹੋ ਜਾਂਦਾ ਹਰ ਕਿਸੇ ਨੂੰ ਹੁੰਦਾ ਕਿ ਮੈਂ ਜਲਦੀ ਜਾਵਾ ਮੈਂ ਜਲਦੀ ਜਾਵਾਂ ਇਸ ਚੱਕਰ 'ਚ ਫਿਰ ਸਾਰੇ ਹੀ ਰਹਿ ਜਾਂਦੇ ਹੋ ਉਸ ਕਰਕੇ ਟਰੈਫਿਕ ਹੋ ਜਾਂਦਾ ਅਤੇ ਕਿਸੇ ਤੋਂ ਵੀ ਨਿਕਲਿਆ ਨਹੀਂ ਜਾਂਦਾ ਅਤੇ ਮੇਰੇ ਹਾਂਜੀ ਸਭ ਹਾਂਜੀ ਸਭ ਨੂੰ ਜਲਦੀ ਲੱਗੀ ਹੁੰਦੀ ਉਤੋਂ ਦੀ ਅੰਦਰ ਵਾਲੇ ਤਾਂ ਸਾਰੇ ਰੋਡ ਹੀ ਬਹੁਤ ਛੋਟੇ ਹੈ ਹਾਂ ਜਿੰਨਾ ਕਰਕੇ ਟਰੈਫਿਕ ਹੋ ਜਾਂਦਾ ਮੇਨ ਮਾਰਕੀਟ ਵਾਲਾ ਰੋਡ ਮੈਨੂੰ ਉਧਰ ਦੀ ਨਿਕਲ ਕੇ ਆਉਣਾ ਪੈਂਦਾ ਔਰ ਉਧਰ ਤਾਂ ਬਹੁਤ ਹੀ ਟਰੈਫਿਕ ਹੁੰਦਾ ਜਿੰਨਾ ਮਰਜ਼ੀ ਘਰੋਂ ਜਲਦੀ ਚੱਲ ਲਓ ਪਰ ਬੰਦਾ ਲੇਟ ਹੋ ਹੀ ਜਾਂਦਾ ਇੱਕ ਵਾਰੀ ਟਰੈਫਿਕ 'ਚ ਫਸ ਗਏ ਉਸ ਤੋਂ ਬਾਅਦ ਤੁਸੀਂ ਮੰਨ ਕੇ ਚੱਲੋ ਵੀ ਤੁਹਾਡੇ ਪੰਦਰਾਂ ਵੀਹ ਮਿੰਟ ਪੱਚੀ ਮਿੰਟ ਕਿਤੇ ਨਹੀਂ ਗਏ ਬਈ ਤੁਹਾਨੂੰ ਨਿਕਲਣ 'ਤੇ ਬਹੁਤ ਟਾਈਮ ਲੱਗ ਜੂਗਾ ਹਾਂਜੀ ਬਿਲਕੁਲ ਸਾਡਾ ਕੋਈ ਹੋਰ ਰਸਤਾ ਵੀ ਨਹੀਂ ਹੁੰਦਾ ਮੇਨ ਬਾਹਰ ਬਾਹਰ ਦੀ ਕੋਈ ਰੋਡ ਹੀ ਨਹੀਂ ਨਿਕਲਦਾ ਵੀ ਜਿਸ ਸਾਈਡ ਤੋਂ ਮੈਂ ਆ ਜਾ ਸਾਰਾ ਪਹਿਲਾਂ ਘਰ 'ਚ ਕੋਈ ਨਿਕਲਣਾ ਹੁੰਦਾ ਪਹਿਲਾਂ ਹੀ ਦਿਮਾਗ 'ਚ ਆਉਣ ਲੱਗ ਜਾਂਦਾ ਵੀ ਜਾਣਾ ਕੰਮ ਹੋਏ ਚਾਹੇ ਦਸ ਮਿਨਟ ਦਾ ਮਾਰਕੀਟ 'ਚ ਪਰ ਦਿਮਾਗ 'ਚ ਇਹੀ ਰਹਿੰਦਾ ਵੀ ਅੱਧਾ ਪੌਣਾ ਘੰਟਾ ਤਾਂ ਮਾਰਕੀਟ 'ਚ ਨਿਕਲਦੇ ਕਰਦੇ ਲੱਗ ਜਾਣੇ ਜੇਕਰ ਟਰੈਫਿਕ 'ਚ ਅਟਕ ਗਏ ਤਾਂ ਦਸ ਮਿੰਟ ਦੇ ਕੰਮ ਲਈ ਤੁਸੀਂ ਸੋਚੋ ਅੱਧਾ ਪੌਣਾ ਘੰਟਾ ਖ਼ਰਾਬ ਕਰਨਾ ਮੈਨੂੰ ਤਾਂ ਵਾਜਿਬ ਨਹੀਂ ਲੱਗਦਾ ਪਰ ਹੁਣ ਕੀ ਕਰ ਸਕਦੇ ਹਾਂ ਮਜ਼ਬੂਰੀ ਹੈ ਕੀ ਨਿਕਲਣਾ ਹਾਂਜੀ ਹਾਂਜੀ ਟਰੈਫਿਕ ਦਾ ਸਲਿਊਸ਼ਨ ਤਾਂ ਕੋਈ ਹੋਣਾ ਚਾਹੀਦਾ ਕਿ ਜਿਵੇਂ ਕਹਿ ਲਓ ਰੋਡਜ ਥੋੜ੍ਹੀਆਂ ਵੱਡੀਆਂ ਕਰ ਦੇਣ ਜਾਂ ਫਿਰ ਇੱਥੇ ਕੋਈ ਸਰਕਾਰ ਪੁਲਿਸ ਮੁਲਾਜ਼ਮ ਰੁਕਵਾ ਦੇ ਕਿ ਉਹ ਟਰੈਫਿਕ ਨੂੰ ਜਲਦੀ ਜਲਦੀ ਕੱਢ ਦਿਆ ਕਰਨ ਲਾਈਟਾਂ ਠੀਕ ਕਰਾ ਦੇਣ ਤਾਂ ਕਿ ਲਾਈਟਾਂ ਜੋ ਹੈ ਬੰਦਾ ਇਜ਼ੀਲੀ ਨਿਕਲ ਸਕੇ ਹਾਂਜੀ ਤਾਂ ਕਿ ਹਾਂ ਡੇ ਬਾਏ ਡੇ ਜਿਹੜਾ ਇਹ ਟਰੈਫਿਕ ਵੱਧਦਾ ਜਾਂਦਾ ਹਰ ਘਰ 'ਚ ਤਾਂ ਚਾਰ ਚਾਰ ਵਹੀਕਲ ਹੋ ਗਿਆ ਹੈ ਹਰ ਕਿਸੇ ਕੋਲ ਆਪਣਾ ਵਹੀਕਲ ਹੈ ਤਾਂ ਹਰ ਕੋਈ ਲੈ ਕੇ ਤੁਰ ਪੈਂਦਾ ਹੁਣ ਸਭ ਨੂੰ ਚਲੋ ਸਭ ਦੀ ਮਜ਼ਬੂਰੀ ਵੀ ਹੁੰਦੀ ਹੈ ਕਿਉਂਕਿ ਸਭ ਨੇ ਆਪਣੇ ਆਪਣੇ ਕੰਮ 'ਤੇ ਜਾਣਾ ਹਰ ਕਿਸ ਅੱਜ ਦੇ ਟਾਈਮ 'ਚ ਹਰ ਕੋਈ ਵਰਕਿੰਗ ਹਰ ਹਰ ਕੋਈ ਚਾਹੁੰਦਾ ਕਿ ਮੈਂ ਵੀ ਵਰਕਿੰਗ ਹੋਵਾਂ ਮੈਂ ਵੀ ਵਰਕਿੰਗ ਹੋਵਾਂ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਤਾਂ ਕਿਸੇ ਦਾ ਨਹੀਂ ਸਰਦਾ ਤਾਂ ਕੰਮ ਕੀਤੇ ਬਿਨਾਂ ਤਾਂ ਹਰ ਕੋਈ ਕੰਮ ਹਾਂਜੀ ਹਾਂਜੀ ਬਿਲਕੁਲ ਇਹ ਇਮਪਰੂਵਮੈਂਟ ਬਹੁਤ ਜ਼ਰੂਰੀ ਹੈ ਕਿਉਂਕਿ ਡੇ ਬਾਏ ਡੇ ਜ਼ਿਆਦਾ ਮੁਸ਼ਕਿਲ ਹੁੰਦੀ ਜਾਂਦੀ ਹੈ ਔਰ ਇਸ ਤਰ੍ਹਾਂ ਦਾ ਫਿਰ ਸਾਡਾ ਟਾਈਮ ਬਹੁਤ ਜ਼ਿਆਦਾ ਖ਼ਰਾਬ ਹੁੰਦਾ ਐਂਡ ਕਦੇ ਕਿਸੇ ਨੂੰ ਐਮਰਜੈਂਸੀ ਵੀ ਹੋ ਸਕਦੀ ਹੈ ਤਾਂ ਜੇ ਬੰਦਾ ਟਰੈਫਿਕ 'ਚੇ ਅਟਕ ਗਿਆ ਤਾਂ ਫਿਰ ਐਮਰਜੈਂਸੀ 'ਚ ਬੰਦਾ ਕੀ ਕਰਦਾ ਉਹਦਾ ਤਾਂ ਬਹੁਤ ਤੋਂ ਨੁਕਸਾਨ ਹੋ ਸਕਦਾ ਕਿਸੇ ਦਾ ਵੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ